ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਾਨਵ ਪਠਾਣੀਆ ਹੈ ਮੈਂ ਪੰਜਾਬ ਵਿੱਚ ਪਠਾਨਕੋਟ ਦਾ ਰਹਿਣ ਵਾਲਾ ਹਾਂ ਜਿੱਦਾਂ ਕਿ ਮੈਨੂੰ ਪ੍ਰਸ਼ਨ ਪੁੱਛਿਆ ਹੈ ਕਿ ਤੁਹਾਡੇ ਸਟੇਟ ਟਰਾਂਸਪੋਰਟ ਦੀ ਕੁਆਲਿਟੀ ਕਿਵੇਂ ਹੈ ਅਗਰ ਮੈਂ ਇਸ ਪ੍ਰਸ਼ਨ ਦਾ ਅਨਸਰ ਆਪਣੇ ਮੁਤਾਬਕ ਦੇਣਾ ਚਾਹਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰੇ ਆਪਣੇ ਸਟੇਟ ਦੀ ਟਰਾਂਸਪੋਰਟ ਕੁਆਲਟੀ ਇੰਨੀ ਚੰਗੀ ਨਹੀਂ ਹੈ ਕਿਉਂਕਿ ਇਹਦੇ ਪਿੱਛੇ ਵੀ ਇੱਕ ਕਾਰਨ ਹੈ ਉਹ ਕਾਰਨ ਕਿਸ ਪ੍ਰਕਾਰ ਹੈ ਕਿ ਮੈਂ ਇੱਕ ਅੰਡਰ ਗ੍ਰੈਜੂਏਟ ਸਟੂਡੈਂਟ ਹਾਂ ਅਤੇ ਮੈਨੂੰ ਆਪਣੇ ਘਰ ਤੋਂ ਕਾਲਜ ਤੱਕ ਜਾਣ ਲਈ ਕੋਈ ਸਾਧਨ ਨਹੀਂ ਹੈ ਇਸ ਲਈ ਮੈਂ ਬਸ ਦੇ ਰਾਹੀਂ ਜਾਂਦਾ ਹਾਂ ਮੈ ਗੁਰਦਾਸਪੁਰ ਦਫਤਰ ਤੋਂ ਬਸ ਪਾਸ ਬਣਾਇਆ ਹੋਇਆ ਹੈ ਪਰ ਮੇਰੀ ਇਹ ਦਿੱਕਤ ਹੈ ਕਿ ਉਹ ਬਸ ਪਾਸ ਸਿਰਫ ਗੌਰਮੈਂਟ ਦੀ ਬੱਸਾਂ 'ਤੇ ਚੱਲਦਾ ਹੈ ਜਿੱਦਾਂ ਕਿ ਆਪਣੀ ਪੰਜਾਬ ਰੋਡਵੇ ਅਗਰ ਮੈਂ ਉਸ ਪੰਜਾਬ ਰੋਡਵੇਜ਼ ਦੀ ਕੁਆਲਿਟੀ ਦੱਸਾਂ ਤਾਂ ਉਹ ਮੈਨੂੰ ਇੰਨੀ ਵਧੀਆ ਨਹੀਂ ਲੱਗਦੀ ਉਹਦਾ ਇਹ ਕਾਰਨ ਹੈ ਕਿ ਉਸ ਵਿੱਚ ਇੰਨੀ ਸਫਾਈ ਨਹੀਂ ਹੁੰਦੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਰੋਡਵੇਜ਼ ਵਿੱਚ ਮਹਿਲਾਵਾਂ ਨੂੰ ਫਰੀ ਟਿਕਟ ਮਿਲਦੀ ਹੈ ਜਿਸ ਦਾ ਫਾਇਦਾ ਉਹ ਲੈ ਰਹੇ ਹਨ

ਜਿੱਦਾਂ ਕਿ ਮੈਂ ਉਹ ਬਸ ਵਿਚ ਬਹਿ ਕੇ ਕੋਲਜ ਜਾਂਦਾ ਹਾਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਉਸ ਦੀ ਕੁਆਲਿਟੀ ਇੰਨੀ ਚੰਗੀ ਨਹੀਂ ਹੈ ਉਸ ਦਾ ਕਾਰਨ ਇਹ ਹੈ ਕਿ ਬਸ ਡਰਾਈਵਰਾਂ ਦੀ ਉਸ ਬਸ ਚਲਾਉਣ ਦੀ ਡਿਊਟੀ ਹੁੰਦੀ ਹੈ ਉਹਨਾਂ ਦੀ ਸੋਚ ਵੀ ਇਹ ਹੈ ਕਿ ਜਿੱਦਾਂ ਕਿ ਬੰਦਾ ਇੱਕ ਅੱਜ ਆ ਕੇ ਜਿਹਦੀ ਅੱਜ ਡਿਊਟੀ ਹੈ ਉਹ ਸਫਾਈ ਕਰਦੂਗਾ ਅਗਲੇ ਦਿਨ ਜਿਹੜਾ ਦੂਜਾ ਆਊਗਾ ਉਹ ਸਫਾਈ ਨਹੀਂ ਕਰੇਗਾ ਤੀਜੇ ਦਿਨ ਇੱਦਾਂ ਹੀ ਜਿਹੜੀ ਡਿਊਟੀ ਚੇਂਜ ਹੁੰਦੀਆਂ ਰਹਿਣਗੀਆਂ ਪਰ ਉਹ ਸਫਾਈ ਨਹੀਂ ਕਰਨਗੇ ਜਿਹਦੇ ਕਾਰਨ ਕਿ ਉਹ ਬਹੁਤ ਗੰਦੀ ਹੋ ਜਾਂਦੀ ਹੈ ਅਤੇ ਮੇਰੀ ਇਹ ਮੰਗ ਹੈ ਕਿ ਸਫਾਈ ਵੱਲ ਧਿਆਨ ਦਿੱਤਾ ਜਾਵੇ ਅਤੇ ਬੱਸ ਡਰਾਈਵਰ ਡਰਾਈਵਿੰਗ ਵੀ ਬੜੀ ਫਾਸਟ ਕਰਦੇ ਹਨ ਜੋ ਕਿ ਬਹੁਤ ਗਲਤ ਹੈ ਧੰਨਵਾਦ